ਭਾਰਤ ਵਿੱਚ ਬਹੁਤ ਨਾਚ ਸ਼ੈਲੀਆਂ ਮਸ਼ਹੂਰ ਹਨ ਜਿਵੇਂ ਕਿ ਕਥਕ ਕੱਚੀ ਪੂੜੀ ਮਣੀਪੁਰੀ ਕਥਕ ਕਲੀ ਭੰਗੜਾ ਗਿੱਧਾ ਝੂੰਮਰ ਅਤੇ ਆਦਿ ਅਤੇ ਇਹਨਾਂ ਸਾਰੇ ਨਾਚ ਸ਼ੈਲੀਆਂ ਵਿੱਚੋਂ ਕਥਕ ਮੇਰਾ ਫੇਵਰੇਟ ਹੈ ਅਤੇ ਇੱਕ ਕਥਕ ਦੇ ਬਹੁਤ ਹੀ ਮਸ਼ਹੂਰ ਆਰਟਿਸਟ ਹੋਏ ਨੇ ਜਿਨ੍ਹਾਂ ਦਾ ਨਾਮ ਪੰਡਿਤ ਬਿਰਜੂ ਮਹਾਰਾਜ ਜੀ ਹੈ ਅਤੇ ਬਿਰਜੂ ਮਹਾਰਾਜ ਜੀ ਨੂੰ ਕਥਕ ਵਿੱਚ ਪਾਏ ਆਪਣੇ ਯੋਗਦਾਨ ਕਰਕੇ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ ਅਤੇ ਉਹਨਾਂ ਨੇ ਆਪਣੇ ਕਥਕ ਅਤੇ ਆਪਣੇ ਨਾਚ ਨਾਲ ਬਾਲੀਵੁੱਡ ਵਿੱਚ ਵੀ ਕਈ ਆਪਣੇ ਸਟੂਡੈਂਟ ਤਿਆਰ ਕੀਤੇ ਹਨ